ਹੈਲੋ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਹਾਂਜੀ ਸ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਹਾਂਜੀ ਹਾਂਜੀ ਵੀਰੇ ਦੱਸੋ ਕੀ ਹੋਇਆ ਠੀਕ ਹੈ ਵੀਰੇ ਅੱਛਾ ਇਹ ਵੀਰੇ ਹਾਂਜੀ ਇਹ ਸਵੇਰ ਦਾ ਪ੍ਰੋਗਰਾਮ ਹੈ ਵੀਰੇ ਕਿ ਸ਼ਾਮ ਦਾ ਅੱਛਾ ਠੀਕ ਹੈ ਵੀਰੇ ਮਤਲਬ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਵੀਰੇ ਆਪਾਂ ਸਾਹਨੇਵਾਲ ਜਾਣਾ ਇਥੋਂ ਤਾਂ ਪਹਿਲਾਂ ਜੀਨੀ ਤੋਂ ਨਹਿਰੋ ਨਹਿਰੋ ਨਹਿਰੋ ਹੋ ਕੇ ਫਿਰ ਗਿੱਲ ਚੌਂਕ ਵੱਲ ਫਿਰ ਢੋਲੇਵਾਲ ਚੋਂਕ ਫਿਰ ਸਾਹਨੇਆਲ ਆ ਗਿਆ ਇੱਦਾਂ ਕਰਦੇ ਨੇ ਹਾਂਜੀ ਹਮ ਹਮ ਅੱਛਾ ਹਾਂਜੀ ਹਾਂਜੀ ਹਾਂਜੀ ਹਮ ਹਮ ਹਮ ਹਮ ਹਾਂਜੀ ਹਾਂਜੀ ਹਾਂ ਸ਼ਾਮੀ ਆਉਣ ਵੇਲੇ ਹੋਇਆ ਛੇ ਵਜੇ ਤੱਕ ਹਾਂਜੀ ਹਾਂਜੀ ਹਮ ਹਮ ਹਮ ਅੱਛਾ ਹਾਂਜੀ ਹਾਂਜੀ ਹਾਂਜੀ ਹੋਰ ਹੋਰ ਵੀਰ ਜੀ ਮਿਲਣ ਨੂੰ ਇੱਧਰ ਹੈ ਧਿਆਨ ਜਿਹਾ ਨਹੀਂ ਗਾ ਆਪਣਾ ਹੋਰ ਰੂਟ ਕਿਹੜਾ ਹੋਵੇਗਾ ਇੱਧਰਲਾ

ਪਰ ਵੀਰੇ ਫਿਰ ਖਰਚਾ ਖਰਚਾ ਪੈ ਜਾਣਾ ਨਾ ਆਪਣਾ ਕਾਲਜ ਆਪਾਂ ਨੂੰ ਇੰਨਾਂ ਦੇਰ ਨਹੀਂ ਲੱਗਾ ਕੱਢ ਦਿੰਦੀ ਐਵਰੇਜ ਕੋਈ ਨਾ ਵੀਰੇ ਦੱਸੋ ਤੁਸੀਂ ਦੇਖੋ ਕਿੰਨਾ ਕੁ ਰੂਟ ਲੱਗਦਾ ਕਿੰਨਾ ਠੀਕ ਹਾਂ ਵੀਰੇ ਕੱਢ ਜੋਗੀ ਇੰਨਾਂ ਔਖਾ ਤਾਂ ਨਹੀਂ ਕਰੇਗੀ ਬਸ ਆਪਾਂ ਨੂੰ ਵਿੱਚ ਰੁਕਣਾ ਨਹੀਂ ਪੈਣਾ ਜੇ ਕਿਤੇ ਰੁਕ ਰਹੇ ਨਾ ਤਾਂ ਔਖਾ ਲੱਗੂ ਕਿਉਂਕਿ ਫਿਰ ਜਿਵੇਂ ਜਾਮ ਜੂਮ ਲੱਗ ਗਿਆ ਖੜ੍ਹੀ ਗੱਡੀ ਅੱਛਾ ਅੱਛਾ ਹਾਂ ਹਾਂ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਬਾਰ੍ਹਾਂ ਤੇਰ੍ਹਾਂ ਸੌ ਰੁਪਇਆ ਵੱਧ ਤੋਂ ਵੱਧ ਇੰਨਾਂ ਇਸ ਤੋਂ ਉੱਪਰ ਤਾਂ ਨਹੀਂ ਹੋਣਾ ਅੱਛਾ ਰੂ ਰੂਟ ਵੀਰੇ ਦੁਬਾਰਾ ਤੋਂ ਦੱਸੀ ਮੈਨੂੰ ਕਿਹੜਾ ਕਹਿ ਰਹੇ ਸੀ ਅੱਛਾ ਅੱਛਾ ਅੱਛਾ ਠੀਕ ਹੈ ਮੈਂ ਇੱਕ ਹੋਰ ਸੁਣ ਲਿਆ ਸੀ ਠੀਕ ਹੈ ਹਾਂਜੀ ਹਾਂਜੀ ਵੀਰੇ ਹੋ ਜਾਣਾ ਫਿਰ ਤਾਂ ਥੋੜ੍ਹਾ ਖਰਚਾ ਪਵੇਗਾ ਚਾਰ ਸਾਢੇ ਚਾਰ ਹਜ਼ਾਰ ਠੀਕ ਹੈ ਹਾਂਜੀ ਓਕੇ

ਹਾਂਜੀ ਹਾਂਜੀ ਪਤਾ ਪਤਾ ਪਤਾ ਲੱਗ ਗਈ ਹਾਂਜੀ ਠੀਕ ਹੈ ਵੀਰ ਜੀ ਹੋਜੂ ਅੱਛਾ ਘੁੰਮ ਕੇ ਆਉਣਾ ਪੈਣਾ ਹਮ ਹਮ ਹਮ ਹਾਂਜੀ ਹਾਂਜੀ ਸਮਝ ਗਿਆ ਵੀਰੇ ਸਮਝ ਗਿਆ ਮੈਂ ਕਰ ਲਾਂਗੇ ਕਰ ਲਾਂਗੇ ਵੀਰੇ ਬਸ ਦੱਸ ਦੋ ਸਵੇਰੇ ਆਉਣਾ ਕਿੰਨੇ ਵਜੇ ਤੁਹਾਡੇ ਕੋਲ ਠੀਕ ਆ ਵੀਰ ਜੀ ਠੀਕ ਹੈ ਜੀ ਹਾਂਜੀ ਹੋ ਜੂਗਾ ਹੋ ਜੂਗਾ ਓਕੇ ਵੀਰ ਜੀ ਓਕੇ